ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਦਰਬਾਰ ਸਾਹਿਬ ਸਾਡੇ ਸ਼ਹਿਰ ਤਰਨ ਤਾਰਨ ਦੇ ਵਿੱਚ ਸਥਾਪਿਤ ਹੈ ਜਿਨ੍ਹਾ ਦੇ ਦਰਸ਼ਨ ਲਈ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਹਨ ਜੋ ਇੱਕ ਸਿੱਖਾਂ ਦੇ ਪੰਜਵੇਂ ਗੁਰੂ ਜੀ ਦੁਆਰਾ ਸਥਾਪਿਤ ਬਹੁਤ ਹੀ ਵੱਡਾ ਇੱਥੇ ਸਰੋਵਰ ਬਣਿਆ ਹੋਇਆ ਹੈ ਅਤੇ ਇੱਥੇ ਮੱਸਿਆ ਲੱਗਦੀ ਹੈ ਅਤੇ ਸੰਗਤਾਂ ਬਹੁਤ ਹੀ ਦੂਰੋਂ ਆ ਆ ਆ ਕੇ ਆਪਣੇ ਇੱਥੇ ਗੁਰੂ ਘਰ ਦੇ ਦਰਸ਼ਨ ਕਰਦੀਆਂ ਹਨ